ਮੀਡੀਆ ਦੀ ਭੂਮਿਕਾ ਰਾਜਨੀਤੀ ਵਿੱਚ ਬਹੁਤ ਅੱਛੀ ਹੈ ਅਤੇ ਉਹ ਸਾਨੂੰ ਬੜਾ ਕੁਛ ਦਿਖਾਉਂਦੀ ਹੈ ਟੈਲੀਵਿਜ਼ਨ ਉੱਤੇ ਮੀਡੀਆ ਦੇ ਬੜੇ ਪ੍ਰੋਗਰਾਮ ਆਉਂਦੇ ਹਨ ਅਤੇ ਅਸੀਂ ਦੇਖ ਲੈਂਦੇ ਹਾਂ ਸਾਨੂੰ ਘਰ ਬੈਠੇ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਹਨ ਅਖ਼ਬਾਰਾਂ ਵਿੱਚ ਵੀ ਬਹੁਤ ਕੁਛ ਆਉਂਦਾ ਹੋਇਆ ਅਸੀਂ ਉਹਨਾਂ ਨੂੰ ਵੀ ਫੜ ਲਏ ਆ ਪੜ੍ਹਦੇ ਹਾਂ ਨਹੀਂ ਤਾਂ ਸਾਨੂੰ ਕੁਛ ਵੀ ਪਤਾ ਨਾ ਲੱਗੇ ਕਿ ਮੀਡੀਆ ਵਿੱਚ ਹੋ ਕੀ ਹੋ ਰਿਹਾ ਬਾਹਰਲੇ ਦੇਸ਼ਾਂ ਵਿੱਚ ਕੀ ਹੁੰਦਾ ਹੈ ਅਸਾਂ ਨੂੰ ਬਾਹਰਲੇ ਦੇਸ਼ਾਂ ਦੀਆਂ ਵੀ ਖ਼ਬਰਾਂ ਮੀਡੀਆ ਤੋਂ ਪਹੁੰਚ ਜਾਂਦੀਆਂ ਹਨ ਮੀਡੀਆ ਵਿੱਚ ਮੀਡੀਆ ਦੀਆਂ ਗੱਲਾਂ ਬੜੀਆਂ ਚੰਗੀਆਂ ਅਤੇ ਸਾਨੂੰ ਸਮਝਦਾਰ ਬਣਾਉਂਦੀਆਂ ਹਨ ਅਸੀਂ ਦੇਖਦੇ ਹਾਂ ਕਿ ਸਾਡੇ ਲਈ ਮੀਡੀਆ ਵਿੱਚ ਕੀ ਕੀ ਬਾਹਰ ਕੀ ਹੋ ਰਿਹਾ ਨਹੀਂ ਤਾਂ ਸਾਨੂੰ ਘਰ ਬੈਠੇ ਹੋਏ ਕੁਛ ਵੀ ਪਤਾ ਨਾ ਚੱਲੇ ਅਸੀਂ ਮੀਡੀਆ ਤੋਂ ਮੀਡੀਆ ਵਿੱਚ ਵ ਵੀ ਹੈ ਵੀ ਮੀਡੀਆ ਦੀ ਵਿਆਖਿਆ ਨਹੀਂ ਕਰ ਸਕਦੇ ਕਿ ਉਹ ਸਾਡੇ ਲਈ ਕੀ ਕੁਛ ਕਰਦੀ ਹੈ ਅਤੇ ਕੀ ਕੁਛ ਕਰਨਾ ਚਾਹੁੰਦੀ ਹੈ ਸਾਨੂੰ ਮੀਡੀਆ ਤੋਂ ਬੜੇ ਬੜੀਆਂ ਚੰਗੀਆਂ ਗੱਲਾਂ ਦਾ ਪਤਾ ਲੱਗਦਾ ਹੈ ਕਿ ਵੀ ਬਾਹਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਕੀ ਹੁੰਦਾ ਹੈ ਅਤੇ ਪ ਨਿਊਜ਼ ਪੇਪਰ ਤੋਂ ਵੀ ਕਈ ਗੱਲਾਂ ਦਾ ਪਤਾ ਲੱਗਦਾ ਹੈ ਮੀਡੀਆ ਵਿੱਚ ਹੋਣ ਵਾਲੀਆਂ ਮੀਡੀਆ ਸਾਨੂੰ ਉਹ ਗੱਲਾਂ ਦੱਸਦਾ ਹੈ ਜਿਹੜੀਆਂ ਸਾਨੂੰ ਘਰ ਬੈਠੇ ਜ ਕਦੇ ਵੀ ਪਤਾ ਨਾ ਲੱਗਣ ਧੰਨਵਾਦ